ਮੇਰਾ ਇੱਕ ਰੈਗੂਲਰ ਕਸਟਮਰ ਹੈ ਮੈਨੂੰ ਇੱਕ ਸੂਟ ਉਹ ਕਢਾਈ ਦੇਣ ਕਰਨ ਲਈ ਦੇਣ ਆਇਆ ਅਤੇ ਉਸ 'ਤੇ ਕਢਾਈ ਕਰਨੀ ਸੀ ਅਤੇ ਉਹ ਕਹਿੰਦਾ ਮੈਨੂੰ ਇਹ ਕਢਾਈ ਪਸੰਦ ਆ ਗਈ ਅਤੇ ਉਹਨੇ ਮੈਨੂੰ ਕਿਹਾ ਕਿ ਇਸ ਸੂਟ 'ਤੇ ਮੈਂ ਇਹ ਕਢਾਈ ਕਰਵਾਉਣੀ ਹੈ ਅਤੇ ਮੈਂ ਉਸ ਸੂਟ ਨੂੰ ਵੇਖਿਆ ਪਰਖਿਆ ਅਤੇ ਉਸ ਸੂਟ 'ਤੇ ਕਾਣੋ ਸੀ ਅਤੇ ਕੁਛ ਡਿਫੈਕਟ ਸੀ ਅਤੇ ਉਸ ਨੂੰ ਮੈਂ ਕਿਹਾ ਕਿ ਇਹ ਸੂਟ ਉੱਤੇ ਕਾਣੋ ਵੀ ਹੈ ਅਤੇ ਡਿਫੈਕਟ ਵੀ ਹੈ ਇਹ ਸੂਟ 'ਤੇ ਕਢਾਈ ਨਹੀਂ ਹੋ ਸਕਦੀ ਤੁਸੀਂ ਹੋਰ ਕਢਾਈ ਕਰਵਾ ਲਓ ਅਤੇ ਉਹ ਕਸਟਮਰ ਕਹਿੰਦੇ ਨਹੀਂ ਮੈਨੂੰ ਤਾਂ ਇਹੀ ਪਸੰਦ ਹੈ ਮੈਂ ਤਾਂ ਇਹੀ ਕਢਾਈ ਕਰਵਾਉਣੀ ਹੈ ਅਤੇ ਤੁਸੀਂ ਵੇਖ ਲਓ ਮੈਂ ਤਾਂ ਪਲੀਜ਼ ਮੇਰੀਆਂ ਮਿੰਨਤਾਂ ਕੀਤੀਆਂ ਉਹਨਾਂ ਨੇ ਕਿ ਇਹੀ ਕਢਾਈ ਕਰ ਦਿਉ ਪਲੀਜ਼ ਅਤੇ ਮੈਂ ਫਿਰ ਉਸ ਸੂਟ ਦੀ ਸਾਰਿਆਂ ਤੋਂ ਸਾਰਿਆਂ ਨੂੰ ਵਿਖਾਇਆ ਅਤੇ ਸਾਰਿਆਂ ਨੂੰ ਦਿਖਾਇਆ ਕਿ ਇਹਨਾਂ ਦੇ ਵਿੱਚ ਡਿਫੈਕਟ ਵੀ ਹੈ ਅਤੇ ਇਸ ਵਿੱਚ ਕਾਣੋ ਵੀ ਹੈ ਅਤੇ ਮੈਂ ਇਹ ਕਢਾਈ ਕਿਵੇਂ ਕਰਾਂ ਅਤੇ ਸ ਲੋਕਾਂ ਤੋਂ ਸਲਾਹ ਲਈ ਅਤੇ ਲੋਕਾਂ ਨੇ ਕਿਹਾ ਕਿ ਤੁਸੀਂ ਇਸ ਕਾਣੋ ਨੂੰ ਕੱਢ ਕੇ ਦੇਖ ਲਓ ਕੀ ਪਤਾ ਸੂਤ ਆ ਜਾਵੇ ਅਤੇ ਉਸ ਉਹਨਾਂ ਨੂੰ ਦਿਖਾਉਣ ਤੋਂ ਬਾਅਦ ਫਿਰ ਮੈਂ ਸੋਚਿਆ ਅਤੇ ਦਿਮਾਗ ਲਗਾਇਆ ਇਸ ਕਾਣੋ ਨੂੰ ਕੱਢ ਕੇ ਅਤੇ ਫਿਰ ਮੈਂ ਸੋਚਿਆ ਅਤੇ ਕੱਢ ਕੇ ਅਤੇ ਮੁੜ ਕੇ ਡਿਫੈਕਟ ਨੂੰ ਵੀ ਪਾਸੇ 'ਤੇ ਕੱਢ ਕੇ ਕਢਾਈ ਕੀਤੀ ਅਤੇ ਉਸ ਗਾਹ ਕਸਟਮਰ ਨੂੰ ਬੜੀ ਪਸੰਦ ਆ ਗਈ ਅਤੇ ਉਸਨੇ ਅਗਾਂਹ ਦਿਖਾਈ ਕਸਟਮਰਾਂ ਨੂੰ ਕਈ ਕਸਟਮਰਾਂ ਨੂੰ ਦਿਖਾਈ ਅਤੇ ਉਹਨਾਂ ਨੂੰ ਬਹੁਤ ਹੀ ਪਸੰਦ ਆਈ ਓਸ ਉਹਨਾਂ ਨੇ ਕਿਹਾ ਕਿ ਤੁਸੀਂ ਕਿੱਥੋਂ ਇਹ ਕਢਾਈ ਕਰਵਾਈ ਹੈ ਉਹ ਕਹਿੰਦੇ ਓਹ ਬੁਟੀਕ ਤੋਂ ਕਰਵਾਈ ਹੈ ਅਤੇ ਹੋਰ ਮੇਰੇ ਕਸਟਮਰ ਉਹਨਾਂ ਨੇ ਲਿਆਉਂਦੇ ਅਤੇ ਮੈਂ ਉਹਨਾਂ ਨੂੰ ਫਿਰ ਉਹਨਾਂ ਨੇ ਵੀ ਹੋਰ ਪਸੰਦ ਕੀਤੇ ਆ ਕੇ ਕਈ ਕਸਟਮਰ ਬਣਾਏ ਅਤੇ ਉਹਨਾਂ ਨੇ ਪਸੰਦ ਕੀਤੀਆਂ ਕਢਾਈਆਂ ਆ ਕੇ ਅਤੇ ਉਹਨਾਂ ਨੇ ਵੀ ਕਿਹਾ ਬਹੁਤ ਸੋਹਣੀ ਕਢਾਈ ਕੀਤੀ ਸੀ ਤੁਸੀਂ ਅਤੇ ਉਹਨਾਂ ਨੇ ਪਸ ਪਸੰਦ ਕਰਕੇ ਉਹਨਾਂ ਨੇ ਵੀ ਸੂਟ ਮੈਨੂੰ ਦਿੱਤੇ ਲਿਆ ਕੇ ਨਵੇਂ ਨਵੇਂ ਅਤੇ ਫਿਰ ਮੈਂ ਉਹਨਾਂ ਦੀਆਂ ਨਵੇਂ ਸੂਟਾਂ 'ਤੇ ਕਢਾਈਆਂ ਵੀ ਕੀਤੀਆਂ ਉਹਨਾਂ ਨੂੰ ਸਾਰੇ ਕਸਟਮਰਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਅਤੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਕਸਟਮਰ ਬਣਾਉਣੇ ਸ਼ੁਰੂ ਕਰਤੇ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਮੇਰੇ ਨਵੇਂ ਤੋਂ ਨਵੇਂ ਕਸਟਮਰ ਬਣ ਗਏ ਅਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕੀਤਾ